ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ

ਮੈਂ ਗੁਰਦਾਸਪੁਰ ਆਈ ਹਾਂ ਹਾਂਜੀ ਜੰਮੂ ਤੋਂ ਆਏ ਹਾਂ ਇੱਥੇ ਅਸੀਂ ਘੁੰਮਣ ਵਾਸਤੇ ਆਏ ਹਾਂ ਅਤੇ ਸਾਨੂੰ ਦੱਸੋ ਵੀ ਇੱਥੇ ਦਾ ਕੀ ਹਿਸਾਬ ਕਿਤਾਬ ਹੈ ਕਿੱਦਾਂ ਦਾ ਕਲਚਰ ਆ ਖਾਣਾ ਕਿੱਦਾਂ ਦਾ ਹਾਂਜੀ

ਹਾਂ ਹਾਂ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂ ਅਤੇ ਹਾਂਜੀ ਹਾਂਜੀ ਅਤੇ ਇੱਥੇ ਰੈਸਟੋਰੈਂਟ ਮਤਲਬ ਵੀ ਕਿਹੜਾ ਮਤਲਬ ਵੀ ਸਸਤਾ ਹੈਗਾ ਜਿੱਥੇ ਮਤਲਬ ਰੋਟੀ ਵਧੀਆ ਹੈ ਅਤੇ ਪੈਸੇ ਵੀ ਘੱਟ ਹੋਣ ਹਾਂਜੀ ਹਾਂਜੀ ਅੱਛ ਹਾਂਜੀ ਹਾਂਜੀ ਅਤੇ ਇੱਥੇ ਕੱਪੜੇ ਕੁੱਪੜੇ ਕਿੱਦਾਂ ਦੇ ਮਤਲਬ ਲੇਡੀਜ਼ ਪਾਉਂਦੇ ਹੈ ਹਾਂਜੀ ਹੋਰ ਕਿਹੜੀਆਂ ਕਿਹੜੀਆਂ ਜਗ੍ਹਾ ਜੇ ਇੱਥੇ ਹੈਗੀਆ ਜਿਹੜੀਆਂ ਘੁੰਮਣ ਵਾਲੀਆਂ ਵੇਖਣ ਵਾਲੀਆਂ ਹੋਣ ਜਿਹੜੇ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਕਿਉਂਕਿ ਅਸੀਂ ਜੰਮੂ ਤੋਂ ਆਏ ਆ ਸਾਨੂੰ ਇੱਥੋਂ ਦਾ ਕੋਈ ਨਹੀਂ ਨੌਲੇਜ ਨਹੀਂ ਹੈਗੀ ਕੋਈ ਪਤਾ ਨਹੀਂ ਹੈਗਾ ਤੇ ਅਸੀਂ ਤਾਂ ਕਰਕੇ ਤੁਹਾਨੂੰ ਹਾਂਜੀ ਠੀਕ ਹੈ ਜੀ ਠੀਕ